ਹਾਂਜੀ ਹੈਲੋ ਠੀਕ ਠਾਕ ਜੀ ਮੈਮ ਤੁਸੀਂ ਸੁਣਾਓ ਬਸ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਚੱਲ ਰਿਹਾ ਕੋਲੇਜ ਦਾ ਨਹੀਂ ਐਡਮਿਸ਼ਨਸ ਸਾਡੀਆਂ ਤਾਂ ਵਧੀਆ ਚੱਲ ਰਹੀਆਂ ਉੱਦਾਂ ਅਸੀਂ ਸੁਣ ਰਹੇ ਹੈ ਕਿ ਬਾਕੀ ਕਾਲਜਾਂ ਦੇ ਵਿੱਚ ਘੱਟ ਕਿ ਪਰ ਨਹੀਂ ਸਾਡੀ ਸਾਈਡ 'ਤੇ ਠੀਕ ਚੱਲ ਰਹੀਆਂ ਐਡਮਿਸ਼ਨਸ ਔਲ ਸਟ੍ਰੀਮ ਦੇ ਵਿੱਚ ਸਾਡੇ ਕੋਲ ਕਿਉਂਕਿ ਸਾਰੇ ਸਟ੍ਰੀਮਸ ਹੈ ਸਾਡੇ ਕੋਲ ਆਰਟਸ ਸਾਇੰਸ ਕੰਪਿਊਟਰ ਵਗੈਰਾ ਸਾਰੇ ਸਟ੍ਰੀਮਸ ਨੇ ਸਾਰਿਆਂ 'ਚ ਵਧੀਆ ਐਡਮਿਸ਼ਨ ਚੱਲ ਰਹੀ ਹੈ ਸਾਡਾ ਵੇਖਿਆ ਮੈਂ ਕਿ ਹੁਣ ਕਿਉਂਕਿ ਆਹ ਕੰਪਿਊਟਰ ਕਰਕੇ ਨਾ ਕਾਫ਼ੀ ਬੱਚੇ ਜਿਹੜੇ ਨੇ ਉਹ ਕੰਪਿਊਟਰ ਦੀ ਐਡਮਿਸ਼ਨਸ ਜਿਹੜੀਆਂ ਜਿਵੇਂ ਬੀ ਸੀ ਏ ਦੇ ਵਿੱਚ ਜਾਂ ਇੱਕ ਸਾਲ ਦੇ ਡਿਪਲੋਮੇ ਦੇ ਵਿੱਚ ਅਤੇ ਬੀ ਐੱਸ ਸੀ ਆਈ ਟੀ ਵਗੈਰਾ ਦੇ ਵਿੱਚ ਨਾ ਕੰਪਿਊਟਰ ਸਾਈਡ 'ਤੇ ਕਾਫ਼ੀ ਮਤਲਬ ਜਿਹੜੀ ਐਡਮਿਸ਼ਨਸ ਹੋਈਆਂ ਨੇ ਸਾਡੀਆਂ ਇਹ ਤਾਂ ਜਦੋਂ ਬੱਚੇ ਤੁਹਾਡੇ ਕੋਲ ਇਨਕੁਐਰੀ ਕਰਨ ਆਉਂਦੇ ਆ ਵੀ ਕਿਹੜੇ ਕਿਹੜੇ ਕੋਰਸ ਨੇ ਉਦੋਂ ਹੀ ਉਹਨਾਂ ਨੂੰ ਥੋੜ੍ਹੇ ਇੱਦਾਂ ਆਪਣੇ ਟੀਚਰਸ ਜਿਹੜੇ ਨੇ ਇਸ ਪਾਸੇ ਲਗਾਓ ਪਹਿਲਾਂ ਆਪਣੀ ਲੈਬ ਦੇ ਵਿੱਚ ਸਾਰੀ ਸੈਟਿੰਗ ਜਿਹੀ ਕਰ ਦਿਉ ਇਸ ਤਰ੍ਹਾਂ ਕਿ ਜਦੋਂ ਐਡਮਿਸ਼ਨ ਵੇਲੇ ਬੱਚੇ ਨੂੰ ਲੱਗੇ ਕਿ ਹਾਂ ਜਿਹੜਾ ਸਾਡਾ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਕੰਪਿਊਟਰ ਦੀ ਜਿਹੜੀ ਨੌਲੇਜ ਹੈ ਬਹੁਤ ਚਾਹੀਦੀ ਆ ਅਤੇ ਐਡਮਿਸ਼ਨ ਇਹਦੇ ਵਾਸਤੇ ਹੀ ਉਹਨਾਂ ਨੂੰ ਗਾਈਡ ਕਰੋ ਠੀਕ ਓਕੇ ਓਕੇ ਥੈਂਕ ਯੂ ਜੀ